ਪੰਜਾਬ ਵਿੱਚ ਬਹੁਤ ਜ਼ਿਆਦਾ ਪਰੰਪਰਾਵਾਂ ਹੁੰਦੀਆਂ ਹਨ ਜੋ ਕਿ ਇਸ ਵਿੱਚ ਪਰੰਪਰਾ ਹੁੰਦੀ ਹੈ ਘਰਵਾਲਾ ਬਾਹਰ ਜਾ ਕੇ ਆਪਣੇ ਘਰਦਿਆਂ ਲਈ ਪੈਸੇ ਕਮਾਉਂਦਾ ਹੈ ਅਤੇ ਪੈਸੇ ਕਮਾ ਕੇ ਆਪਣੇ ਘਰਵਾਲੀ ਦੇ ਹੱਥ ਵਿੱਚ ਰੱਖਦਾ ਹੈ ਉਹਦੀ ਘਰਵਾਲੀ ਦੀ ਡਿਊਟੀ ਹੁੰਦੀ ਹੈ ਕਿ ਉਹ ਘਰਦਿਆਂ ਦਾ ਧਿਆਨ ਰੱਖੇ ਅਤੇ ਸਾਰਿਆਂ ਲਈ ਖਾਣਾ ਬਣਾਵੇ ਅਤੇ ਸਾਰਿਆਂ ਦੇ ਕੱਪੜੇ ਧੋਵੇ ਅਤੇ ਸਾਰਿਆਂ ਦਾ ਧਿਆਨ ਚੰਗੀ ਤਰ੍ਹਾਂ ਰੱਖੇ ਅਤੇ ਆਪਣੇ ਘਰ ਦੀ ਸਫਾਈ ਵੀ ਰੱਖੇ ਅਤੇ ਪਹਿਲਾਂ ਦੇ ਜ਼ਮਾਨੇ ਵਿੱਚ ਕੁੜੀਆਂ ਨੂੰ ਸ਼ੁੱਭ ਨਹੀਂ ਸੀ ਮੰਨਿਆ ਜਾਂਦਾ ਪਹਿਲਾਂ ਇਹ ਸੋਚਦੇ ਸੀ ਕਿ ਸਾਡੇ ਘਰ ਮੁੰਡਾ ਹੀ ਹੋਵੇ ਪਰ ਅੱਜ ਕੱਲ੍ਹ ਇਹ ਸੋਚ ਖਤਮ ਹੋ ਚੁੱਕੀ ਹੈ ਅੱਜ ਕੱਲ੍ਹ ਕੁੜੀਆਂ ਨੂੰ ਵੀ ਮੁੰਡਿਆਂ ਜਿੰਨਾ ਹੀ ਦਰਜਾ ਦਿੱਤਾ ਜਾਂਦਾ ਹੈ ਧੰਨਵਾਦ